ਸਾਡਾ ਵਪਾਰ ਕੁਦਰਤੀ ਸਰੋਤਾਂ 'ਤੇ ਨਿਰਭਰ ਹੈ ਜਿਵੇਂ ਰੂਨ ਪਾਣੀ ਅਤੇ ਫ਼ਸਲ ਉਸ ਲਈ ਸਾਨੂੰ ਫ਼ਸਲ ਕਿਸਮ ਪ੍ਰਾਪਤ ਹੋਣ ਵਾਲੀ ਫ਼ਸਲਾਂ ਦੀ ਮਾਤਰਾ 'ਤੇ ਨਿਰਭਰ ਕਰਦੀ ਹੈ ਪ੍ਰਕਿਰਤੀ ਸਾਨੂੰ ਸਾਫ਼ ਪਾਣੀ ਦਿੰਦੀ ਹੈ ਦੂਸ਼ਿਤ ਹਵਾ ਨੂੰ ਪੇੜ ਪੌਦੇ ਸਾਫ਼ ਕਰਦੇ ਹਨ ਅਤੇ ਸਮੁੰਦਰਾਂ ਤੋਂ ਖੁਰਾਕ ਮਿਲਦੀ ਹੈ ਸਾਡੇ ਖੇਤਰਾਂ ਵਿੱਚ ਕੁਦਰਤੀ ਸਰੋਤਾਂ ਤੋਂ ਵਪਾਰ ਕੀਤਾ ਜਾਂਦਾ ਹੈ ਜਿਵੇਂ ਤੇਲ ਕੋਲਾ ਪ੍ਰਕਿਰਤਿਕ ਗੈਸ ਧਾਤੂ ਪੱਥਰ ਅਤੇ ਰੇਤ ਹੋਰ ਕੁਦਰਤੀ ਸਰੋਤ ਹਨ ਹਵਾ ਧੁੱਪ ਮਿੱਟੀ ਅਤੇ ਪਾਣੀ ਜਾਨਵਰ ਚਿੜੀਆਂ ਮੱਛੀ ਅਤੇ ਪੇੜ ਪੌਦੇ ਕੁਦਰਤੀ ਸਰੋਤ ਖਾਣਾ ਬਣਾਉਣ ਲਈ ਅਤੇ ਈਧਨ ਲਈ ਅਤੇ ਕੱਚੇ ਮਾਲ ਦੇ ਤੌਰ 'ਤੇ ਚੀਜ਼ਾਂ ਨੂੰ ਬਣਾਉਣ ਲਈ ਵਰਤੇ ਜਾਂਦੇ ਹਨ ਕੁਦਰਤੀ ਸਰੋਤ ਵੱਡੇ ਵੱਡੇ ਕਾਰਖਾਨਿਆਂ ਲਈ ਵਪਾਰ ਲਈ ਕੱਚਾ ਮਾਲ ਦਿੰਦੇ ਹਨ ਜਿਵੇਂ ਕੋਲੇ ਪੈਟਰੋਲੀਅਮ ਅੱਜ ਕੱਲ੍ਹ ਤਾਜ਼ਾ ਅਤੇ ਸਾਫ਼ ਪਾਣੀ ਦੀ ਘਾਟ ਹੋ ਰਹੀ ਹੈ ਇਸ ਲਈ ਪਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ ਪਰ ਬੜੇ ਧਿਆਨ ਨਾਲ ਪਾਣੀ ਵਰਤਣਾ ਚਾਹੀਦਾ ਹੈ ਤਾਂ ਜੋ ਕਿ ਪਾਣੀ ਖ਼ਰਾਬ ਨਾ ਹੋਵੇ ਸਾਡੇ ਖੇਤਰਾਂ ਵਿੱਚ ਕੁਦਰਤੀ ਸਰੋਤ ਹਨ ਹਵਾ ਜਿਹੜੀ ਹਵਾ ਊਰਜਾ ਦਾ ਕੰਮ ਕਰਦੀ ਹੈ ਦੂਸਰਾ ਜਾਨਵਰ ਖਾਨਾ ਦਾ ਕੰਮ ਦਿੰਦੇ ਹਨ ਵਪਾਰ ਵਿੱਚ ਦੁੱਧ ਪਨੀਰ ਉੱਨੀ ਕੱਪੜੇ ਜਾਨਵਰਾਂ ਤੋਂ ਹੀ ਮਿਲਦੇ ਹਨ ਸਾਨੂੰ ਉਹਨਾਂ ਦੀ ਵੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਸਵੈਟਰ ਸਿਲਕ ਸ਼ਰਟ ਚਮੜੇ ਦੀਆਂ ਬੈਲਟਾਂ ਇਹ ਸਭ ਸਾਨੂੰ ਜਾਨਵਰਾਂ ਤੋਂ ਹੀ ਮਿਲਦਾ ਹੈ ਤੀਜਾ ਕੋਲ ਜਿਸ ਤੋਂ ਬਿਜਲੀ ਵੀ ਬਣਦੀ ਹੈ ਚੌਥਾ ਮਿਨਰਲਸ ਸਿੱਕਾ ਤਾਰਾਂ ਸਟੀਲ ਐਲਮੀਨੀਅਮ ਕੈਨ ਅਤੇ ਜਵੈਲਰੀ ਬਣਦੇ ਹਨ ਕੁਦਰਤੀ ਸਰੋਤ ਵਿੱਚ ਤੀਜਾ ਤਿੰਨ ਚੀਜ਼ਾਂ ਜ਼ਰੂਰੀ ਹਨ ਪਾਣੀ ਹਵਾ ਜਿਸ ਵਿੱਚ ਬਿਨਾਂ ਅਸੀਂ ਜਿੰਦਾ ਨਹੀਂ ਰਹਿ ਸਕਦੇ ਜੰਗਲ ਇਸ ਵਿੱਚ ਬਹੁਤ ਸਹਾਇਤਾ ਕਰਦਾ ਹੈ ਇਹ ਸਾਡਾ ਬੜਾ ਕੀਮਤੀ ਸੰਪਤੀ ਹੈ ਜਿਹੜੀ ਵਾਰ ਵਾਰ ਉੱਗ ਕੇ ਸਾਡੀ ਵਪਾਰ ਵਿੱਚ ਸਹਾਇਤਾ ਕਰਦੀ ਹੈ ਜਿਵੇਂ ਪੇੜ ਲੱਕੜ ਦੇ ਰੂਪ ਵਿੱਚ ਫਰਨੀਚਰ ਦੇ ਬਿਜ਼ਨਸ ਦੇ ਬਹੁਤ ਕੰਮ ਆਉਂਦੇ ਹਨ ਇਸ ਲਈ ਸਾਨੂੰ ਆਪਣੇ ਜੰਗਲ ਦਾ ਵੀ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਅਤੇ ਪੇੜ ਪੌਦੇ ਲਗਾਉਂਦੇ ਰਹਿਣਾ ਚਾਹੀਦਾ ਹੈ ਪਾਣੀ ਵੀ ਬਹੁਤ ਕੀਮਤੀ ਸੰਪਤੀ ਹੈ ਜੋ ਜੰਗਲਾਂ ਵਿੱਚੋਂ ਨਿਕਲ ਕੇ ਆਉਂਦਾ ਹੈ ਕੁਦਰਤੀ ਸਰੋਤ ਇੱਕ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜਬੂਤ ਮਜਬੂਤ ਕਰਦੇ ਹਨ ਇਸ ਉੱਤੇ ਹਰ ਤਰ੍ਹਾਂ ਦਾ ਵਪਾਰ ਨਿਰਭਰ ਕਰਦਾ ਹੈ ਪਾਣੀ ਤੋਂ ਬਿਨਾਂ ਤਾਂ ਅਸੀਂ ਜਿਉਂਦੇ ਵੀ ਨਹੀਂ ਰਹਿ ਸਕਦੇ ਇਹ ਸਾਡੇ ਕਲਚਰ ਦਾ ਅੰਗ ਹੈ ਸਾਰੇ ਤਰ੍ਹਾਂ ਦੇ ਵਪਾਰ ਲਈ ਧਰਤੀ ਪਾਣੀ ਅਤੇ ਕੱਚਾ ਮਾਲ ਇਕੱਠਾ ਕਰਨਾ ਹੁੰਦਾ ਹੈ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਕਾਫੀ ਮਾਤਰਾ ਵਿੱਚ ਸਾਡੇ ਕੋਲ ਕੁਦਰਤੀ ਸਰੋਤ ਹੋਣ ਇਸ ਲਈ ਇਹਨਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਇਸ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਦੇ ਵਿਕਾਸ ਵੱਲ ਵੀ ਬਹੁਤ ਧਿਆਨ ਦੇਣ ਦੀ ਲੋੜ ਹੈ ਇਸ ਲਈ ਸਰਕਾਰ ਨੂੰ ਖ਼ਾਸ ਧਿਆਨ ਦੇਣ ਦੀ ਲੋੜ ਹੈ ਸੰਸਥਾ ਬਣਾਉਣ ਦੀ ਵੀ ਲੋੜ ਹੈ ਇਸ ਲਈ ਬਾਹਰੀ ਜ਼ਰੂਰਤਾਂ ਜਿਵੇਂ ਰਾਜਨੀਤਿਕ ਜਥੇਬੰਦੀਆਂ ਅਤੇ ਆਰਥਿਕ ਜਥੇਬੰਦੀਆਂ ਅਤੇ ਕਾਨੂੰਨੀ ਜਥੇਬੰਦੀਆਂ ਵੀ ਦੀ ਵੀ ਲੋੜ ਹੈ ਜੋ ਇਸ ਪਾਸੇ ਪੂਰਾ ਧਿਆਨ ਦੇਣ ਕਿਉਂਕਿ ਹੀਰਾ ਅਤੇ ਸੋਨਾ ਵੀ ਕੁਦਰਤੀ ਸਰੋਤ ਵਿੱਚ ਸ਼ਾਮਿਲ ਹਨ ਅਤੇ ਵਪਾਰ ਦਾ ਬਹੁਤ ਮਹਿੰਗਾ ਅਤੇ ਲਾਭਦਾਇਕ ਸਰੋਤ ਹੈ ਭਾਰਤ ਸੰਸਾਰ ਦਾ ਚੌਥਾ ਕੋਲੇ ਦਾ ਵੱਡਾ ਕੁਦਰਤੀ ਸਰੋਤ ਹੈ ਲੋਹਾ ਅਤੇ ਮੈਗਨੀਜ਼ ਦਾ ਸੰਸਾਰ ਦਾ ਸੱਤਵਾਂ ਵੱਡਾ ਕੁਦਰਤੀ ਸਰੋਤ ਹੈ ਲੀਥੀਅਮ ਸੰਸਾਰ ਦਾ ਛੇਵਾਂ ਵੱਡਾ ਕੁਦਰਤੀ ਸਰੋਤ ਹੈ ਮੀਕਾ ਬੋਕਸਾਈਡ ਸੰਸਾਰ ਦਾ ਪੰਜਵਾਂ ਵੱਡਾ ਕੁਦਰਤੀ ਸਰੋਤ ਹੈ ਫਰੋਮਾਇਲ ਨੈਚੁਰਲ ਗੈਸ ਡਾਈਮੰਡ ਲਾਈਮਸਟੋਂਨ ਫ੍ਰੋਰੀਅਮ ਇਸ ਦਾ ਭਾਰਤ ਸੰਸਾਰ ਦਾ ਵੱਡਾ ਸਰੋਤ ਹੈ ਭਾਰਤ ਸਾਡਾ ਬਹੁਤ ਵੱਡਾ ਕੁਦਰਤੀ ਨੈਚੁਰਲ ਸਰੋਤ ਹੈ